ਸਤਿ ਸ਼੍ਰੀ ਅਕਾਲ ਸਾਡੇ ਇੱਥੇ ਸੈਲਾਨੀ ਆਕਰਸ਼ਣ ਲਈ ਜੇ ਮੰਨਿਆ ਜਾਵੇ ਤਾਂ ਪਹਿਲੀ ਗੱਲ ਜਿੱਦਾਂ ਕਿ ਮੈਂ ਪਠਾਨਕੋਟ ਜਿਲ੍ਹੇ ਦੀ ਹੈਗੀ ਹਾਂ ਅਤੇ ਮੇਨ ਸਾਡਾ ਸ਼ਹਿਰ ਜਿਹੜਾ ਹੈ ਉਹ ਸੁਜਾਨਪੁਰਾ ਅਤੇ ਸੁਜਾਨਪੁਰ ਵਿੱਚ ਪਹਿਲੀ ਗੱਲ ਬੱਸ ਸਟੈਂਡ ਨਹੀਂ ਹੈਗਾ ਤਾਂ ਸੱਭ ਤੋਂ ਜ਼ਰੂਰੀ ਤਾਂ ਹੈ ਉਹ ਹੈਗਾ ਕਿ ਪਹਿਲੇ ਬੱਸ ਸਟੈਂਡ ਬਣਾਇਆ ਜਾਵੇ ਸੈਲਾਨੀ ਫਿਰ ਹੀ ਆਉਣਗੇ ਕੋਈ ਬਾਹਰੋਂ ਆਏਗਾ ਫਿਰ ਹੀ ਆਊਗਾ ਨਹੀਂ ਤਾਂ ਪਠਾਨਕੋਟ ਤੋਂ ਓਟੋ ਕੈਬ ਜੋ ਵੀ ਚੀਜ਼ ਹੈ ਉਹ ਕਰਾ ਕੇ ਆਉਣਾ ਪੈਂਦਾ ਜਾਂ ਫਿਰ ਕਿਸੇ ਦਾ ਆਪਣਾ ਸਾਧਨ ਹੋਵੇ ਤਾਂ ਉਨ੍ਹਾਂ ਨੂੰ ਸੁੱਖ ਰਹਿੰਦਾ ਪਹਿਲੀ ਗੱਲ ਤਾਂ ਬੱਸ ਸਟੈਂਡ ਬਹੁਤ ਜ਼ਰੂਰੀ ਹੈ ਅਤੇ ਦੂਸਰੀ ਚੀਜ਼ ਵੈਸੇ ਤਾਂ ਸਾਡੇ ਲਾਗੇ ਡਾਊਨ ਟਾਊਨ ਬਣਿਆ ਹੋਇਆ ਬਹੁਤ ਜ਼ਿਆਦਾ ਮਤਲਬ ਉੱਥੇ ਲੋਕ ਆਉਂਦੇ ਜਿਨ੍ਹਾਂ ਨੇ ਵੀ ਜੰਮੂ ਤੋਂ ਪੰਜਾਬ ਜਾਣਾ ਹੁੰਦਾ ਜਾਂ ਪੰਜਾਬ ਤੋਂ ਜੰਮੂ ਆਉਂਦੇ ਹੈ ਸਾਰੇ ਹਰ ਕੋਈ ਰੁਕ ਕੇ ਆਉਂਦਾ ਤਾਂ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਬਣ ਸਕਦੀਆਂ ਹੈ ਜਿਵੇਂ ਕਿ ਜਿਵੇਂ ਕਿ ਕੁਛ ਬੱਚਿਆਂ ਦੇ ਖੇਡਣ ਲਈ ਗੇਮ ਜੋਨਜ਼ ਹੋ ਗਈਆਂ ਉਹ ਬਣ ਸਕਦੀਆਂ ਕੋਈ ਪਾਰਕ ਬਣ ਸਕਦੀ ਹੈ ਕੋਈ ਸਾਫ਼ ਸੁਥਰੀ ਸੋਹਣੀ ਪਾਰਕ ਹੋ ਜਾਵੇ ਤਾਂ ਜਾਂ ਫਿਰ ਕੁਛ ਰੇਲਵੇ ਸਟੇਸ਼ਨਸ ਜਿੱਦਾਂ ਉਹ ਡੈਵਲੇਪ ਹੋ ਥੋੜ੍ਹੇ ਜਿਹੇ ਡੈਵਲੇਪ ਹੋ ਜਾਣ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਕੁਛ ਘੁੰਮਣ ਫਿਰਨ ਲਈ ਕੁਛ ਮੋਲ ਕੁਛ ਇੱਕ ਦੋ ਮੋਲ ਵੱਧ ਬਣ ਜਾਣ ਬਸ ਹੋਰ ਤਾਂ ਕੀ ਹੈਗਾ